ਨੈਤਿਕਤਾ ਅਤੇ ਨੈਤਿਕ ਸਿੱਖਿਆ ਦੀ ਮਹੱਤਤਾ ਪੰਜਾਬ ਦੇ ਨੌਜਵਾਨਾਂ ਦੇ ਚਰਿੱਤਰ ਅਤੇ ਕ ਕਦਰਾਂ ਕੀਮਤਾਂ ਨੂੰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਕਦਰਾਂ ਕੀਮਤਾਂ ਹਰ ਇੱਕ ਨੌਜਵਾਨਾਂ ਦੀਆਂ ਆਪਣੇ ਆਪ ਦੇ ਨਾਲ ਬਹੁਤ ਮਹੱਤਤਾ ਰੱਖਦੀਆਂ ਹਨ ਅੱਜ ਕੱਲ੍ਹ ਬੱਚਿਆਂ ਕੋਲ ਐਜੂਕੇਸ਼ਨ ਤਾਂ ਵੱਧ ਤੋਂ ਵੱਧ ਹੈ ਪਰ ਬੱਚਿਆਂ ਦੀ ਨੈਤਿਕਤਾ ਅਤੇ ਨੈਤਿਕ ਸਿੱਖਿਆ ਦਿਨੋਂ ਦਿਨ ਘੱਟਦੀ ਜਾ ਰਹੀ ਹੈ ਪੰਜਾਬ ਦੇ ਨੌਜਵਾਨਾਂ ਦੇ ਚਰਿਤਰਾਂ ਵਿੱਚ ਕਦਰਾਂ ਕੀਮਤਾਂ ਨੂੰ ਜਾਰੀ ਰੱਖਣ ਲਈ ਬੱਚੇ ਆਪਣੇ ਮਾਤਾ ਪਿਤਾ ਦੀ ਗੱਲਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਅਤੇ ਆਪਣੀ ਮਨ ਮਰਜ਼ੀ ਕਰਦੇ ਹਨ ਅਤੇ ਸਹਿਣਸ਼ੀਲਤਾ ਨੌਜਵਾਨਾਂ ਦੇ ਵਿੱਚ ਬਹੁਤ ਘੱਟ ਗਈ ਹੈ ਇਸੇ ਕਰਕੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਬਹੁਤ ਜ਼ਿਆਦਾ ਲੋੜ ਹੈ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੇ ਵਿੱਚ ਆਪਸੀ ਮੋਹ ਪ੍ਰੇਮ